ਅੱਜ ਦੇ ਸਮੇਂ ਦੇ ਵਿੱਚ ਸਥਾਨਕ ਬੈਂਕ ਵੀ ਬਹੁਤ ਇੰਪੋਰਟੈਂਟ ਰੋਲ ਪਲੇਅ ਕਰਦੇ ਆ ਆਪਾਂ ਸਾਰੀਆਂ ਟਰਾਂਜੈਕਸ਼ਨ ਘਰ ਬੈਠੇ ਔਨਲਾਈਨ ਨਹੀਂ ਕਰ ਸਕਦੇ ਇਸ ਲਈ ਕਈ ਕਾਰਣਾਂ ਕਰਕੇ ਕਈ ਜ਼ਰੂਰਤਾਂ ਕਰਕੇ ਆਪਾਂ ਨੂੰ ਆਪਣੀ ਸਥਾਨਕ ਬੈਂਕ 'ਤੇ ਜਾਣਾ ਪੈਂਦਾ ਜਿਵੇਂ ਕੀ ਲੋਨ ਜਦੋਂ ਆਪਾਂ ਲੋਨ ਦੀ ਜ਼ਰੂਰਤ ਪੈਂਦੀ ਆ ਅਤੇ ਉਹ ਆਪਾਂ ਸਾਰੀਆਂ ਟਰਾਂਜੈਕਸ਼ਨਸ ਔਨਲਾਈਨ ਨਹੀਂ ਕਰ ਸਕਦੇ ਇਸ ਲਈ ਆਪਾਂ ਨੂੰ ਬੈਂਕ ਜਾਣਾ ਪੈਂਦਾ ਵਾ ਸਾਰੀਆਂ ਫੋਰਮੈਲਿਟੀਜ਼ ਨੂੰ ਪੂਰੀਆਂ ਕਰਨਾ ਪੈਂਦਾ ਅਤੇ ਫਿਰ ਹੀ ਲੋਨ ਮਿਲਦਾ ਅਤੇ ਕਈ ਵਾਰ ਆਪਾਂ ਨੂੰ ਕੈਸ਼ ਦੀ ਜ਼ਰੂਰਤ ਵੀ ਪੈਂਦੀ ਹੈ ਕਿਉਂਕਿ ਆਪਾਂ ਹਰ ਕਿਤੇ ਔਨਲਾਈਨ ਪੇਮੈਂਟਸ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਕਈ ਜਗ੍ਹਾ 'ਤੇ ਔਨਲਾਈਨ ਪੇਮੈਂਟ ਦੀ ਆਪਸ਼ਨ ਅਵੇਲੇਬਲ ਨਹੀਂ ਹੁੰਦੀ ਇਸ ਲਈ ਆਪਾਂ ਨੂੰ ਕੈਸ਼ ਦੀ ਜ਼ਰੂਰਤ ਪੈਂਦੀ ਆ ਕੈਸ਼ ਵਿਦਡਰਾਅ ਕਰਾਉਣ ਦੇ ਲਈ ਆਪਾਂ ਨੂੰ ਬੈਂਕ ਜਾਣਾ ਪੈਂਦਾ ਜਾਂ ਫਿਰ ਜੇ ਆਪਾਂ ਏ ਟੀ ਐੱਮ ਨੂੰ ਯੂਜ ਕਰਨਾ ਹੋਵੇ ਤਾਂ ਵੀ ਆਪਾਂ ਨੂੰ ਬੈਂਕ ਵਿਜਿਟ ਕਰਨਾ ਪੈਂਦਾ ਬੈਂਕ ਦਾ ਆਪਾਂ ਏ ਟੀ ਐੱਮ ਯੂਜ ਕਰਦੇ ਹਾਂ ਫਿਰ ਕੈਸ਼ ਨੂੰ ਵਿਦਡਰਾਅ ਕਰ ਸਕਦੇ ਹਾਂ ਕਈ ਵਾਰ ਆਪਾਂ ਟੋਟਲੀ ਆਪਾਂ ਪੂਰੀ ਤਰੀਕੇ ਦੇ ਨਾਲ ਵਿਸ਼ਵਾਸ ਨਹੀਂ ਕਰ ਸਕਦੇ ਕਿ ਸਾਰੀਆਂ ਟਰਾਂਜੈਕਸ਼ਨ ਆਪਾਂ ਔਨਲਾਈਨ ਕਰੀਏ ਇਸ ਲਈ ਆਪਾਂ ਨੂੰ ਬੈਂਕ ਵਿਜਿਟ ਕਰਨਾ ਪੈਂਦਾ ਆਪਾਂ ਪਰਸਨਲੀ ਸਾਰੇ ਆਪਣੇ ਕੰਮ ਕਰਦੇ ਹਾਂ ਪੂਰੇ ਕਰਦੇ ਹਾਂ ਇਸ ਲਈ ਜਿਹੜੇ ਆਪਣੀ ਸਥਾਨਕ ਬੈਂਕ ਆ ਉਹ ਵੀ ਬਹੁਤ ਇੰਪੋਰਟੈਂਟ ਰੂਲ ਰੋਲ ਜਾਂ ਫਿਰ ਬਹੁਤ ਹੀ ਇੰਪੋਰਟੈਂਟ ਭੂਮਿਕਾ ਨਿਭਾਉਂਦੇ ਆ